ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਸਬਕ ਸਿੱਖੇ ਆ ਜੀ ਮੈਂ ਇੱਕ ਦਿਨ ਅਚਾਨਕ ਆਪਣੇ ਮੋਟਰਸਾਈਕਲ 'ਤੇ ਘਰੋਂ ਜਾ ਰਿਹਾ ਸੀ ਜੀ ਅਤੇ ਰਸਤੇ ਵਿੱਚ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਜੀ ਅਤੇ ਮੇਰੇ ਕਾਗਜ਼ ਪੱਤਰ ਮੋਟਰਸਾਈਕਲ ਦੇ ਸਾਰੇ ਪੂਰੇ ਸੀ ਅਤੇ ਮੈਂ ਇੱਕ ਚੀਜ਼ ਮਾੜੀ ਜਿਹੀ ਭੁੱਲ ਗਿਆ ਜੀ ਘਰ ਆਪਣਾ ਹੈਲਮਟ ਭੁੱਲ ਗਿਆ ਜੀ ਉਹਨਾਂ ਕਰਕੇ ਮੈਨੂੰ ਪੁਲਿਸ ਵਾਲਿਆਂ ਨੇ ਕਿਹਾ ਜੀ ਕਿੱਥੇ ਆ ਤੇਰਾ ਹੈਲਮਟ ਮੈਂ ਕਿਹਾ ਸਰ ਗਲਤੀ ਹੋ ਗਈ ਜੀ ਕੋਈ ਗੱਲ ਨਹੀਂ ਜੀ ਅਤੇ ਬਹੁਤ ਮੈਂ ਮਿੰਨਤਾਂ ਕਰੀਆਂ ਜੀ ਉਹਨਾਂ ਕਰਕੇ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਜੀ ਅਤੇ ਉਹਨਾਂ ਨੇ ਮੈਨ ਮੇਰਾ ਚਲਾਨ ਦੋ ਹਜ਼ਾਰ ਰੁਪਏ ਦਾ ਕਰਤਾ ਜੀ ਉਹਦੇ ਕਰਕੇ ਮੈਂ ਬਹੁਤ ਦੁਖੀ ਹੋਇਆ ਜੀ ਮੈਂ ਕਿਹਾ ਗਲਤੀ ਨਾਲ ਮਾੜੀ ਜਿਹੀ ਗਲਤੀ ਪਿੱਛੇ ਵੀ ਦੋ ਹਜ਼ਾਰ ਰੁਪਏ ਦਾ ਨੁਕਸਾਨ ਕ ਕਰਾ ਲਿਆ ਜੀ ਅੱਗੇ ਤੋਂ ਮੈਂ ਇਹ ਚੀਜ਼ ਦਾ ਜੀ ਬਹੁਤ ਧਿਆਨ ਰੱਖਾਂਗਾ ਜੀ ਅਤੇ ਘਰ ਤੋਂ ਜਦੋਂ ਵੀ ਤੁਰਾਂਗਾ ਜੀ ਇਹ ਚੀਜ਼ ਦਾ ਸਾਰੀਆਂ ਗੌਰ ਕਰਕੇ ਤੁਰੇ ਕਰਾਂਗਾ ਜੀ ਮੈਂ ਵੀ ਕਿਹੜੀ ਚੀਜ਼ ਦੀ ਜਰੂਰਤ ਆ ਨਾਲ ਲੈ ਕੇ ਹੀ ਤੁਰਾਂਗਾ ਜੀ